ਮੈਂ ਗੁਪਤਾ ਮਨਿਆਰੀ ਦੀ ਦੁਕਾਨ ਤੋਂ ਆਪਣੇ ਵਾਲਾਂ ਲਈ ਆਪਣੀ ਸਹੇਲੀ ਦੇ ਕਹੇ 'ਤੇ ਪਹਿਲੀ ਵਾਰ ਇੱਕ ਕੰਡੀਸ਼ਨਰ ਖਰੀਦਿਆ ਸੀ ਪਰ ਜਿਸ ਵਾਲਾਂ ਦੀ ਝੜਨ ਦੀ ਮੁਸ਼ਕਿਲ ਨੂੰ ਇਹ ਕੰਡੀਸ਼ਨਰ ਲਿਆ ਸੀ ਮੈਨੂੰ ਇਸ ਦਾ ਕੋਈ ਫਾਇਦਾ ਨਹੀਂ ਦਿਸ ਰਿਹਾ ਸਗੋਂ ਇਸ ਨੇ ਮੇਰੇ ਸਾਰੇ ਵਾਲ ਰੁੱਖੇ ਕਰ ਦਿੱਤੇ ਹਨ ਅਤੇ ਝਾੜ ਦਿੱਤੇ ਹਨ ਇਸ ਦੀ ਇੰਨੀ ਕੀਮਤ ਹੋਣ ਦੇ ਬਾਵਜੂਦ ਵੀ ਮੈਨੂੰ ਇਸ ਦਾ ਕੋਈ ਨਤੀਜਾ ਨਹੀਂ ਮਿਲਿਆ ਮੇਰੇ ਲਈ ਇਸ ਕੰਡੀਸ਼ਨਰ ਦਾ ਅਨੁਭਵ ਬਿਲਕੁਲ ਚੰਗਾ ਨਹੀਂ ਰਿਹਾ